ਯੋਗਾ ਬਿਨਾਂ ਸ਼ੱਕ ਇੱਕ ਵਿਅਕਤੀਗਤ ਅਭਿਆਸ ਹੈ ਅਭਿਆਸ ਵਿਅਕਤੀਗਤ ਹੈ ਅਤੇ ਹਾਲਾਂਕਿ ਅਸੀਂ ਉਸ ਮਾਰਗ 'ਤੇ ਚੱਲਦੇ ਹਾਂ ਹਰ ਵਿਅਕਤੀ ਦੀ ਯਾਤਰਾ ਅੰਤ ਵਿੱਚ ਵਿਲੱਖਣ ਹੁੰਦੀ ਹੈ ਸਾਡੇ ਸਾਰਿਆਂ ਕੋਲ ਯੋਗਾ ਕਲਾਸ ਦੇ ਦੌਰਾਨ ਉਹ ਪਲ ਹੁੰਦਾ ਹੈ ਜਦੋਂ ਅਸੀਂ ਹੌਲੀ ਹੋਣਾ ਰੁਕਣਾ ਕਮਰੇ ਤੋਂ ਬਾਹਰ ਭੱਜਣਾ ਚਾਹੁੰਦੇ ਹਾਂ ਇਹ ਕਮਰੇ ਵਿੱਚ ਬਹੁਤ ਗਰਮ ਹੋ ਸਕਦਾ ਹੈ ਸਾਡਾ ਸਰੀਰ ਥੱਕ ਜਾਂਦਾ ਹੈ

ਇਸ ਤਰ੍ਹਾਂ ਮੈਟ ਤੋਂ ਬਾਹਰ ਅਸੀਂ ਸਾਰੇ ਜੀਵਨ ਦੀਆਂ ਸਥਿਤੀਆਂ ਵਿੱਚ ਵਿਰੋਧ ਦਾ ਸਾਹਮਣਾ ਕਰਦੇ ਹਾਂ ਜੋ ਸਾਨੂੰ ਛੱਡਣ ਜਾਂ ਹਾਰ ਮੰਨਣ ਲਈ ਮਜਬੂਰ ਕਰਦੇ ਹਨ ਤੁਹਾਡੇ ਯੋਗਾ ਅਭਿਆਸ ਵਿੱਚ ਤੁਹਾਡੇ ਕੋਲ ਲਚਕੀਲੇਪਨ ਅਤੇ ਅੰਦਰੂਨੀ ਤਾਕਤ ਨੂੰ ਵਿਕਸਿਤ ਕਰਨ ਦਾ ਮੌਕਾ ਹੁੰਦਾ ਹੈ ਤੁਹਾਡੇ ਅਭਿਆਸ ਵਿੱਚ ਮੁਸ਼ਕਿਲ ਖੋਜਾਂ ਜਾਂ ਪਲਾਂ ਵਿੱਚੋਂ ਸਾਹ ਲੈਣ ਅਤੇ ਸਵਾਸਨਾ ਅੰਤਿਮ ਅਰਾਮ ਅਤੇ ਪ੍ਰਤੀਬਿੰਬਿਤ ਖੋਜ ਲਈ ਆਪਣਾ ਰਸਤਾ ਲੱਭਣ ਲਈ ਜੋ ਕੰਮ ਤੁਸੀਂ ਆਪਣੇ ਯੋਗਾ ਮੈਟ 'ਤੇ ਕਰਦੇ ਹੋ ਉਹ ਤੁਹਾਡੇ ਜੀਵਨ ਦੇ ਹਰ ਪਹਿਲੂ ਵਿੱਚ ਅਨੁਵਾਦ ਕਰਦਾ ਹੈ ਯੋਗਾ ਮੈਟ ਦੇ ਪੋਜ ਤੁਹਾਨੂੰ ਕਲਾਸ ਵਿੱਚ ਅਤੇ ਤੁਹਾਡੀ ਰੋਜ਼ਾਨਾ ਗੱਲਬਾਤ ਵਿੱਚ ਕਿਵੇਂ ਦਿਖਾਈ ਦੇ ਰਹੇ ਹਨ ਇਸ ਤੱਕ ਪਹੁੰਚਣ ਪ੍ਰਦਾਨ ਕਰਦੇ ਹਨ